ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯੋਗਾ ਅਭਿਆਸ ਇੱਕ ਬਹੁਤ ਸਾਧਾਰਨ ਚੀਜ ਹੁੰਦੀ ਐ ਪਰ ਹਾਂ ਜੇ ਕੋਈ ਲੋ ਵਿਅਕਤੀ ਨਵਾਂ ਨਵਾਂ ਉਸਦੇ ਨਾਲ ਜੁੜਿਆ ਜਾਂ ਫੇਰ ਉਹਦਾ ਪਹਿਲਾ ਦਿਨ ਐ ਤੇ ਉਹਨੂੰ ਬਹੁਤ ਸੋਚ ਸਮਝ ਕੇ ਕਰਨਾ ਚਾਈਦਾ ਐ ਜਿਵੇਂ ਕੀ ਜੇ ਅਧਿਆਪਕ ਯੋਗਾ ਅਧਿਆਪਕ ਜੇ ਤੁਹਾਨੂੰ ਇੱਕ ਆਸਨ ਛੇ ਛੇ ਵਾਰੀ ਕਰਵਾ ਰਿਆ ਧਾਨੂੰ ਇੱਕ ਪਹਿਲੇ ਦਿਨ ਵਿੱਚ ਉਹਨੂੰ ਇੱਕ ਵਾਰੀ ਕਰਨਾ ਚਾਈਦੈ ਕਿਉਂਕੀ ਸਾਡੀ ਜਿਹੜੀ ਸ਼ਰੀਰ ਐ ਸਾਡਾ ਜਿਹੜਾ ਸ਼ਰੀਰ ਐ ਉਹ ਸਾਨੂੰ ਇਜਾਜਤ ਨੀ ਦਿੰਦਾ ਵੀ ਅਸੀਂ ਇੱਕ ਦਿਨ ਆ ਕੇ ਪਹਿਲੇ ਦਿਨ ਆ ਕੇ ਹੀ ਓਹਨੂੰ ਅਸੀਂ ਇੱਕ ਆਸਨ ਨੂੰ ਛੇ ਛੇ ਵਾਰੀ ਕਰੀਏ ਤੇ ਦੂਜਾ ਜਿਹੜਾ ਸਾਨੂੰ ਆਪਣੇ ਸ਼ਰੀਰ ਨੂੰ ਵਧੀਆ ਰੱਖਣ ਲਈ ਯੋਗਾ ਤੇ ਕਰਨਾ ਹੀ ਚਾਈਦਾ ਹੈ ਤੇ ਮੈਂ ਸਿਰਫ਼ ਐਹ ਸਲਾਹ ਦਊਂਗੀ ਵੀ ਤੁਸੀਂ ਜਿੰਨਾ ਤੁਹਾਡਾ ਸ਼ਰੀਰ ਤੁਹਾਨੂੰ ਇਜਾਜਤ ਦਿੰਦਾ ਐ ਤੁਸੀਂ ਓਨਾ ਕਰੋ ਕਿਉਂਕੀ ਜੇ ਕੱਲ ਨੂੰ ਮੰਨ ਲੋ ਜੇ ਤੁਸੀਂ ਛੁੱਟੀ ਕਰਨੀ ਹੋਵੇ ਤੇ ਤਾਡਾ ਸ਼ਰੀਰ ਜਿਹੜਾ ਹੈ ਆਕੜ ਜਾਏਗਾ ਤੇ ਤੁਸੀਂ ਤੀਜੇ ਦਿਨ ਆ ਕੇ ਸ਼ ਆਪਨਾ ਯੋਗਾ ਅਭਿਆਸ ਨਹੀਂ ਕਰ ਸਕੋਗੇ ਹਾਂ ਜਦੋਂ ਤੁਹਾਡਾ ਅਧਿਆਪਕ ਪਹਿਲਾ ਦਿਨ ਪਹਿਲਾ ਦਿਨ ਹੈ ਤਾਡਾ ਤੇ ਅਧਿਆਪਕ ਛੇ ਵਾਰੀ ਇੱਕੋ ਹੀ ਆਸਣ ਕਰਵਾ ਰਿਆ ਕਿਉਂਕੀ ਜਿਹੜੇ ਉਹਦੇ ਨਾਲ ਪੁਰਾਨੇ ਵੀ ਜਿਹੜੇ ਵਿਦਿਆਰਥੀ ਹਨ ਯੋਗਾ ਵਾਸਤੇ ਜੁੜੇ ਹੋਏ ਹਨ ਉਹ ਉਨ੍ਹਾਂ ਅਨੁਸਾਰ ਕਰਾਂਦਾ ਪਿਆ ਐ ਹਾਂ ਤੁਸੀਂ ਆਪਨਾ ਪਹਿਲੇ ਦਿਨ ਆ ਕੇ ਇੱਕ ਵਾਰੀ ਉਸ ਆਸਨ ਨੂੰ ਕਰੋ ਤੇ ਦੂਜੇ ਦਿਨ ਆ ਕੇ ਭਾਵੇਂ ਦੋ ਵਾਰੀ ਕਰ ਲੋ ਤੇ ਤੀਜੇ ਦਿਨ ਆ ਕੇ ਤਿੰਨ ਵਾਰੀ ਕਰ ਲੋ ਤੇ ਏਦਾਂ ਏਦਾਂ ਈ ਤੁਸੀਂ ਉਹਨੂੰ ਹੋਲੀ ਹੋਲੀ ਵਧਾਓ ਕੀ ਤਾਡਾ ਸ਼ਰੀਰ ਵਿੱਚ ਜਿਹੜੀਆਂ ਖਲੀਆਂ ਹਨ ਉਹ ਨਾ ਪੈਣ ਜੇ ਇਨ ਕੇਸ ਤੁਸੀਂ ਕਿਤੇ ਜਾਣਾ ਹੋਵੇ ਤੇ ਓਥੇ ਜਿਆਦਾ ਦੇਰ ਲਈ ਬੈਠਣਾ ਹੋਵੇ ਤੇ ਤੁਸੀਂ ਬੈਠ ਪਾਓ ਤੇ ਤੁਹਾਨੂੰ ਸਰੀਰ ਵਿੱਚ ਖਲੀਆਂ ਜਾਂ ਫੇਰ ਤੁਹਾਨੂੰ ਸ਼ਰੀਰ ਵਿੱਚ ਕੋਈ ਕਮੀ ਮਹਿਸੂਸ ਨਾ ਹੋਵੇ ਕੀ ਤੁਸੀਂ ਹਾਂ ਬੈਠ ਨੀ ਪਾ ਰਹੇ ਜਾਂ ਫੇਰ ਕੁਛ ਕਰ ਨੀ ਪਾ ਰਹੇ ਤੇ ਹਾਂ ਦੂਜੇ ਦਿਨ ਜਾ ਕੇ ਆਪਨੇ ਅਧਿਆਪਕ ਨੂੰ ਜੇ ਤੁਹਾਨੂੰ ਕੋਈ ਪ੍ਰੋ ਜੇ ਤੁਹਾਨੂੰ ਕੋਈ ਸਮੱਸਿਆ ਆਂਦੀ ਹੈ ਯੋਗਾ ਅਭਿਆਸ ਕਰਨ ਸਮੇਂ ਧਾਨੂੰ ਦੱਸਣਾ ਚਾਈਦਾ ਹੈ ਤੇ ਹਾਂ ਮੈਂ ਐਹੀ ਸਲਾਹ ਦਊਂਗੀ ਵੀ ਤੁਸੀਂ ਆਪਣੇ ਜਿੰਨੀ ਤਾਡੀ ਸ਼ਰੀਰ ਅਲੋ ਇਜਾਜਤ ਦਿੰਦਾ ਹੈ ਤੁਸੀਂ ਓਨੂੰ ਓਨਾ ਹੀ ਕਰੋ ਤੇ ਹਾਂ ਦੂਜੀ ਗੱਲ ਜਦੋਂ ਵੀ ਤੁਸੀਂ ਯੋਗਾ ਕਰਨਾ ਐ ਜਿਵੇਂ ਤਾਡਾ ਚਾਰ ਵਜੇ ਦਾ ਯੋਗਾ ਐ ਤੁਸੀਂ ਘੱਟੋ ਘੱਟ ਦੋ ਘੰਟੇ ਪਹਿਲਾਂ ਖਾਣਾ ਆਪਣਾ ਖਾਓ ਤੇ ਖਾਣਾ ਖਾ ਕੇ ਅਰਾਮ ਨਾਲ ਬੈਠ ਜੋ ਕੀ ਯੋਗਾ ਦੇ ਦੋ ਘੰਟੇ ਪਹਿਲਾਂ ਤੁਸੀਂ ਕੁਛ ਨਾ ਖਾਦਾ ਹੋਵੇ ਤੇ ਤਾਡਾ ਜਿਹੜਾ ਸ਼ਰੀਰ ਐ ਉਹ ਅਰਾਮ ਨਾਲ ਖਾਲੀ ਪੇਟ ਯੋਗਾ ਕਰ ਸਕੋ ਤੇ ਤਾਡਾ ਜਿਹੜੀ ਉਲਟੀਆਂ ਵਗਾਰਾ ਦੀ ਸਮੱਸਿਆ ਜਿਹੜੀ ਹੈ ਉਹ ਧਾਨੂੰ ਨਾ ਆਵੇ ਤੇ ਤੁਹਾਡੇ ਜਿਹੜੀ ਸ਼ਰੀਰ ਅਰਾਮ ਨਾਲ ਯੋਗਾ ਦਾ ਅਭਿਆਸ ਕਰ ਸਕੇ ਤੇ ਧਾਨੂੰ ਜਿਆਦਾ ਭਾਰਾਪਨ ਮਹਿਸੂਸ ਨਾ ਹੋਵੇ ਕੀ ਤੁਸੀਂ ਹਾਂ ਕੁਛ ਖਾਣਾ ਖਾਦਾ ਹੋਇਆ ਐ ਤੇ ਤੁਸੀਂ ਕਰ ਨੀ ਪਾ ਰਹੇ ਧੰਨਵਾਦ